ਬਾਈਕਿੰਗ ਯੁਵਾ ਮੁੰਡਿਆਂ ਲਈ ਇੱਕ ਅਜਿਹਾ ਸ਼ੌਂਕ ਹੈ ਜਿਸ ਦਾ ਕੋਈ ਮੁੱਲ ਨਹੀਂ ਹੈ ਹੁਣ ਦੇਖ ਹੀ ਲਓ ਸਸਤੀ ਤੋਂ ਸਸਤੀ ਬਾਈਕ ਪੰਜਾਹ ਸੱਠ ਹਜ਼ਾਰ ਤੱਕ ਦੀ ਮਿਲ ਜਾਂਦੀ ਹੈ ਪਰ ਮਹਿੰਗੀ ਤੋਂ ਮਹਿੰਗੀ ਕਰੋੜਾਂ 'ਚ ਵੀ ਮਿਲ ਜਾਂਦੀ ਹੈ ਪਰ ਇੱਕ ਬਾਈਕਰ ਕਰਦਾ ਵੀ ਸਮਾਜ ਪ੍ਰਤੀ ਫਰਜ਼ ਬਣਦਾ ਹੈ ਪਹਿਲਾਂ ਤਾਂ ਇਹ ਕਿ ਉਹ ਅਨੁਸ਼ਾਸਿਤ ਹੋ ਕੇ ਬਾਈਕ ਚਲਾਵੇ ਜਿਵੇਂ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਕਰੇ ਸਪੀਡ ਹੱਦ ਵਿੱਚ ਰਹਿ ਕੇ ਬਾਈਕ ਚਲਾਵੇ ਆਪਣੀ ਬਾਈਕ ਦੇ ਜ਼ਰੂਰੀ ਕਾਗਜ਼ ਜਿਵੇਂ ਕਿ ਆਰ ਸੀ ਇਨਸ਼ੋਰੈਂਸ ਅਤੇ ਪਲਿਊਸ਼ਨ ਸਰਟੀਫਿਕੇਟ ਸਭ ਕੁਝ ਅਪ ਟੂ ਡੇਟ ਰੱਖੇ ਡਰਾਈਵਿੰਗ ਵੇਲੇ ਹੈਲਮਟ ਜਾਂ ਪਗੜੀ ਪਹਿਨੀ ਹੋਵੇ ਵੱਡੇ ਹਾਰਨ ਜਾਂ ਵੱਡੇ ਸਲੈਂਸਰ ਦੀ ਵਰਤੋਂ ਨਾ ਕਰੇ ਜਿਹਦੇ ਨਾਲ ਹਵਾ ਪ੍ਰਦੂਸ਼ਣ ਹੁੰਦਾ ਹੈ ਅਤੇ ਮਾੜੇ ਸਿਹਤ ਵਾਲੇ ਬੰਦਿਆਂ ਦੀ ਸਿਹਤ 'ਤੇ ਵੀ ਅਸਰ ਹੋਣ ਦਾ ਡਰ ਰਹਿੰਦਾ ਹੈ ਇਹ ਸਭ ਚੀਜ਼ਾਂ ਦੀ ਪਾਲਣਾ ਕਰਕੇ ਹੀ ਇੱਕ ਚੰਗੀ ਭਾਵਨਾ ਦਾ ਸੰਕੇਤ ਦਿੱਤਾ ਜਾ ਸਕਦਾ ਹੈ ਜਿਹਦੇ ਨਾਲ ਇੱਕ ਬਾਈਕਰ ਸਮਾਜ ਦੀ ਸਮਾਨਤਾ ਨੂੰ ਉਤਸ਼ਾਹਿਤ ਕਰਨ ਵਿੱਚ ਸਹਾਇਤਾ ਕਰਦਾ ਹੈ ਬਾਕੀ ਜਿਸ ਤਰੀਕੇ ਨਾਲ ਵੀ ਮੁੰਡਾ ਬਾਈਕ ਚਲਾਵੇ ਜਾਂ ਜੋ ਵੀ ਜਿੱਦਾਂ ਕਰੇ ਉਹਦੀ ਸਰਾਣਾ ਕਰਨੀ ਅਤੁਲਨੀਏ ਹੈ ਧੰਨਵਾਦ